ਪੰਜਾਬੀ ਭਾਸ਼ਾ ਪੂਰੇ ਭਾਰਤ ਦੀ ਪ੍ਰਮੁੱਖ ਭਾਸ਼ਾ ਹੈ ਪੰਜਾਬੀ ਭਾਸ਼ਾ ਪੰਜਾਬ ਦੇ ਨਾਲੋਂ ਨਾਲ ਹੋਰ ਸਟੇਟਾਂ ਵਿੱਚ ਵੀ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਅਤੇ ਹਿੰਦੀ ਭਾਸ਼ਾ ਵਿੱਚ ਬਹੁਤ ਸਮਾਨਤਾ ਹੈ ਪੰਜਾਬੀ ਅਤੇ ਹਿੰਦੀ ਦੇ ਕੁਝ ਸ਼ਬਦ ਰਲਦੇ ਮਿਲਦੇ ਹਨ ਮਾਤਰਾਂ ਜਿਵੇਂ ਮਾਤਰਾਂ ਜਿਵੇਂ ਆਪਣੇ ਨਾਮ ਵਗੈਰਾ ਵਗੈਰਾ ਪੰਜਾਬ ਪੰਜਾਬੀ ਨਾਲ ਸੰਬੰਧ ਰੱਖਦਾ ਹੈ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਹੈ ਇਸ ਦੇ ਨਾਲ ਹੀ ਨਾਲ ਇਹ ਭਾਰਤ ਦੀ ਵੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਮੰਨਦੇ ਹਨ ਕਿਉਂਕਿ ਇਹ ਸਰਕਾਰੀ ਕੰਮਾਂ ਵਿੱਚ ਵੀ ਵਰਤੀ ਜਾਂਦੀ ਹੈ ਇਸ ਨਾਲ ਲੋਕ ਆਪਣੇ ਮਾਣ ਵੀ ਸਮਝਦੇ ਹਨ ਅਤੇ ਮੈਂ ਉਹਨਾਂ ਨੂੰ ਆਸਾਨੀ ਵੀ ਹੁੰਦੀ ਹੈ ਇਸ ਹਿੰਦੀ ਭਾਸ਼ਾ ਥੋੜ੍ਹੀ ਔਖੀ ਹੁੰਦੀ ਹੈ ਜਿਸ ਕਾਰਨ ਪੰਜਾਬੀ ਭਾਸ਼ਾ ਨੂੰ ਲੋਕ ਜ਼ਿਆਦਾ ਸਮਝਦੇ ਹਨ ਅਤੇ ਉਸ ਨੂੰ ਜ਼ਿਆਦਾ ਮਾਨਤਾ ਦਿੰਦੇ ਹਨ ਪੰਜਾਬੀ ਭਾਸ਼ਾ ਪੂਰੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਵੀ ਭਾਸ਼ਾ ਹੈ